ਸਤਿ ਸ਼੍ਰੀ ਅਕਾਲ ਜੀ ਖੇਤੀਬਾੜੀ ਦਾ ਜੀ ਜ਼ਿਆਦਾ ਨੌਲੇਜ ਤਾਂ ਹੈ ਨਹੀਂ ਪਰ ਇੰਨਾ ਪਤਾ ਹੈਗਾ ਮੈਨੂੰ ਜਿਵੇਂ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਜਿਹੜੇ ਭਾਰਤ ਦੇ ਵਿੱਚ ਕਿਸਾਨ ਰਹਿੰਦੇ ਆ ਉਹ ਪਹਿਲਾਂ ਅੱਜ ਤੋਂ ਦਸ ਵੀਹ ਸਾਲ ਪਹਿਲਾਂ ਦੀ ਜੇ ਗੱਲ ਕਰੀਏ ਜਿਵੇਂ ਸੁਣਦੇ ਹਾਂ ਬਜ਼ੁਰਗਾਂ ਤੋਂ ਉਸ ਹਿਸਾਬ ਨਾਲ ਤਾਂ ਜਮਾਂ ਹੀ ਕੁਝ ਹੁੰਦਾ ਨਹੀਂ ਸੀ ਜਿਹੜੇ ਬੈਲ ਹੈਗੇ ਸੀ ਇਹਨਾਂ ਨੂੰ ਲੈ ਕੇ ਖੁਦਾਈ ਜੁਤਾਈ ਕਰਦੇ ਰਹਿੰਦੇ ਸੀ ਬੀਜ ਵੀ ਆਪਣੇ ਹੱਥਾਂ ਨਾਲ ਹੀ ਪਾਉਂਦੇ ਸੀ ਖੇਤਾਂ 'ਚ ਅਤੇ ਧੀਰੇ ਧੀਰੇ ਧੀਰੇ ਮਸ਼ੀਨਾਂ ਆ ਗਈਆਂ ਨੇ ਹਰ ਇੱਕ ਚੀਜ਼ ਦੇ ਲਈ ਭਾਵੇਂ ਬੀਜ ਪਾਉਣਾ ਹੋਵੇ ਜ਼ਮੀਨ ਨੂੰ ਪੱਟਣੀ ਹੋਵੇ ਹੈਂ ਪਾਣੀ ਲਾਉਣਾ ਹੋਵੇ ਜਾਂ ਅੱਜ ਕੱਲ੍ਹ ਤਾਂ ਫਸਲ ਨੂੰ ਵੀ ਕੱਟਣ ਦੇ ਲਈ ਵੀ ਮਸ਼ੀਨਾਂ ਆ ਗਈਆਂ ਨੇ ਉਹ ਨਾਲ ਦੀ ਨਾਲ ਹੀ ਫਸਲ ਕੱਟ ਵੀ ਦਿੰਦੀਆਂ ਨੇ ਅਤੇ ਨਾਲ ਦੀ ਨਾਲ ਵੀ ਕਣਕ ਦੇ ਦਾਣੇ ਵੀ ਕੱਢ ਕੇ ਸਾਈਡ 'ਚ ਕਰ ਦਿੰਦੀਆਂ ਨੇ ਉਹ ਸਾਰੀਆਂ ਚੀਜ਼ਾਂ ਟੈਕਨੋਲੋਜੀ ਦੇ ਹਿਸਾਬ ਨਾਲ ਤਬਦੀਲੀਆਂ ਜਿਹੜੀਆਂ ਹੈ ਉਹ ਖੇਤੀਬਾੜੀ ਦੇ ਵਿੱਚ ਆਈ ਹੈ ਅਤੇ ਕਿਸਾਨਾਂ ਨੂੰ ਕਾਫੀ ਸੁਵਿਧਾਵਾਂ ਸੁਵਿਧਾਵਾਂ ਅੱਜ ਕੱਲ੍ਹ ਮਿਲਣ ਲੱਗੀਆਂ ਨੇ